ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਸਟੂਡੈਂਟ ਵਿੱਚ ਪਹੁੰਚਦਾ ਹਾਂ ਅਤੇ ਸਾਗਤ ਨੂੰ ਤਿਆਰ ਕਰਦਾ ਹਾਂ ਮੈਂ ਆਪਣੇ ਵਿਦਿਆਰਥੀਆਂ ਨੂੰ ਨਮਸਤੇ ਕਰਦਾ ਹਾਂ ਅਤੇ ਉਨਾਂ ਨੂੰ ਕਲਾਸ ਲਈ ਤਿਆਰ ਹੋਣ ਲਈ ਕਹਿੰਦਾ ਹਾਂ ਕਲਾਸ ਦੌਰਾਨ ਅਸੀਂ ਭੰਗੜਾ ਦੇ ਬੰਦਾ ਨਾਲ ਸ਼ੁਰੂ ਕਰਦੇ ਹਾਂ ਜਿਸ ਨਾਲ ਵਿਦਿਆਰਥੀਆਂ ਨੂੰ ਗਰਮ ਕਰਨ ਅਤੇ ਉਹਨਾਂ ਦੀ ਊਰਜਾ ਨੂੰ ਵਧਾਉਣ ਵਿੱਚ ਮਦਦ ਮਿਲਦੀ ਹੈ ਅਸੀਂ ਫੇਰ ਐਰੋਬਿਕਸ ਦੀਆਂ ਕੁਝ ਮੁਢਲੀਆਂ ਕਿਸਮਾਂ ਸਿੱਖਦੇ ਹਾਂ ਜਿਵੇਂ ਕਿ ਜੈਪਿੰਗ ਜੈਕਸ ਜੋਕਿੰਗ ਸਟੈਪਿੰਗ ਅਸੀਂ ਭੰਗੜੇ ਦੇ ਮੁੱਖ ਕਦਮਾਂ ਦਾ ਅਭਿਆਸ ਕਰਦੇ ਹਾਂ ਜਿਵੇਂ ਕਿ ਢੋਲ ਦੇ ਨਾਲ ਨੱਚਣਾ ਅਤੇ ਲੱਤਾਂ ਅਤੇ ਬਾਹਵਾਂ ਦੀ ਗਤੀ ਕਲਾਸ ਦੇ ਅੰਤ ਵਿੱਚ ਅਸੀਂ ਇੱਕ ਸਮੂਹਿਕ ਨਾਚ ਦਾ ਅਭਿਆਸ ਕਰਦੇ ਹਾਂ ਜਿਸ ਵਿੱਚ ਸਾਰੇ ਵਿਦਿਆਰਥੀ ਭਾਗ ਲੈਂਦੇ ਹਨ